ਮੇਰੇ ਅਨੁਸਾਰ ਜਿਹੜੀ ਆਯੁਰਵੈਦਿਕ ਦਵਾਈ ਹੈ ਕਿ ਇਹ ਜਾਂ ਹੋਮਿਓਪੈਥੀਕ ਹੈ ਇਹ ਕਾਫ਼ੀ ਠੀਕ ਹੈ ਅ ਅਸੀਂ ਡਾਕਟਰ ਕੋਲ ਜਾਂਦੇ ਹਾਂ ਹੌਸਪੀਟਲ ਵਿੱਚ ਜਾਂਦੇ ਹਾਂ ਠੀਕ ਹੈ ਉੱਥੋਂ ਵੀ ਅਸੀਂ ਮੈਡੀਸਨ ਲੈਂਦੇ ਹਾਂ ਠੀਕ ਹੈ ਉਹ ਵੀ ਆਪਣੀ ਥਾਂ ਵਧੀਆ ਹੈ ਪਰ ਸੁਣਨ ਵਿੱਚ ਆਉਂਦਾ ਹੈ ਕਿ ਆਮ ਲੋਕਾਂ ਦਾ ਜਿਹੜਾ ਹੈਗਾ ਹੈ ਕਿ ਉਹਨਾਂ ਦੀ ਇਹ ਸੋਚ ਹੈ ਕਿ ਜਿਹੜੀ ਆਪਾਂ ਹੋਮਿਓਪੈਥੀਕ ਦੀ ਦਵਾਈ ਲੈਂਦੇ ਹਾਂ ਇਹ ਕੋਈ ਜ਼ਿਆਦਾ ਤੇਜ਼ ਨਹੀਂ ਹੁੰਦੀ ਸਟਰੋਗ ਨਹੀਂ ਹੁੰਦੀ ਠੀਕ ਹੈ ਕਿ ਇਹ ਛੋਟੇ ਬੱਚਿਆ ਤੋਂ ਲੈ ਕੇ ਬਜ਼ੁਰਗਾਂ ਤੱਕ ਹਰ ਇੱਕ ਜਿਹੜਾ ਏਜ ਗਰੁੱਪ ਹੈ ਉਹਨੂੰ ਅਗਰ ਅਸੀਂ ਦੇਈਏ ਤਾਂ ਇਹਦਾ ਵੀ ਕੋਈ ਵੀ ਜਿਹੜਾ ਸਾਈਡ ਇਫੈਕਟ ਹੈ ਉਹ ਨਹੀਂ ਹੁੰਦਾ ਅਤੇ ਵੇਸੈ ਵੀ ਅਗਰ ਇਹਨੂੰ ਕੋਈ ਵੀ ਫਾਈਨੈਸ਼ਲੀ ਜਿਵੇਂ ਦਾ ਵੀ ਹੋਵੇ ਵਿਅਕਤੀ ਸਟਰੋਗ ਹੋਵੇ ਮੀਡੀਅਮ ਹੋਵੇ ਲੋਅਰ ਹੋਵੇ ਹਰ ਇੱਕ ਬੰਦਾ ਇਹਨੂੰ ਆਸਾਨੀ ਨਾਲ ਜਿਹੜੀ ਹੈ ਡਾਕਟਰ ਕੋਲੋਂ ਦਵਾਈ ਲੈ ਸਕਦਾ ਹੈ